ਹਾਂ ਮੇਰੇ ਸਕੂਲ ਵਿੱਚ ਲਾਈਬ੍ਰੇਰੀ ਹੈ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ ਮੈਂ ਬਚਪਨ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜੋ ਕਿ ਮੇਰੇ ਵਿਸ਼ਿਆਂ ਨਾਲ ਸੰਬੰਧਿਤ ਹਨ ਜਿੱਦਾਂ ਕਿ ਐੱਸ ਐੱਸ ਟੀ ਦੀਆਂ ਬੁੱਕਾਂ ਜਾਂ ਫਿਰ ਹਿਸਟਰੀ ਦੀਆਂ ਬੁੱਕਾਂ ਜਿਹਦੇ ਵਿੱਚ ਦੇਸ਼ ਵਿਦੇਸ਼ ਦੇ ਸਾਰੇ ਅੰਦੋਲਨ ਵਗੈਰਾ ਬਾਰੇ ਲਿਖਿਆ ਹੈ ਮੈਂ ਇੰਗਲਿਸ਼ ਦੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜਿੱਦਾਂ ਕਿ ਥਰੀ ਮੈਨ ਇੰਨ ਆ ਵੋਟ ਉਹਦੇ ਵਿੱਚ ਤਿੰਨ ਬੰਦੇ ਬੋਟ ਦੇ ਵਿੱਚ ਜਾਂਦੇ ਹਨ ਅਤੇ ਆਪਸ ਵਿੱਚ ਗੱਲਬਾਤ ਕਰਦੇ ਹਨ ਅਤੇ ਉਹਦੇ ਬਾਰੇ ਉਹ ਕਹਾਣੀ ਹੈ ਮੈਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜਿੱਦਾਂ ਕਿ ਗੁਲੀਬਰ ਡਰੈਵਲ ਜੋ ਮੈਂ ਲਾਈਬ੍ਰੇਰੀ 'ਚੋਂ ਲਿਤੀ ਸੀ ਅਤੇ ਇਹ ਕਿਤਾਬ ਬਹੁਤ ਵਧੀਆ ਸੀ ਇਹਦੇ ਵਿੱਚ ਇੱਕ ਵੱਡਾ ਜਿਹਾ ਬੰਦਾ ਹੁੰਦਾ ਹੈ ਜਿਸ ਨੂੰ ਛੋਟੇ ਛੋਟੇ ਲੋਕ ਬੰਨ੍ਹ ਲੈਂਦੇ ਹਨ ਅਤੇ ਉਹਨਾਂ ਬਾਰੇ ਇਹ ਕਹਾਣੀ ਹੈ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜਿੱਦਾਂ ਕਿ ਆਪਣੇ ਵਿਸ਼ਿਆਂ ਦੇ ਰਿਲੇਟਿਡ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਕਿਉਂਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਅਤੇ ਇਹ ਕਿਤਾਬਾਂ ਮੈਨੂੰ ਨੌਲੇਜ ਗੇਨ ਕਰਨ ਲਈ ਬਹੁਤ ਹੈਲਪ ਕਰਦੇ ਹਨ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਸਾਡੀ ਪੰਜਾਬੀ ਇੰਗਲਿਸ਼ ਅਤੇ ਹਿੰਦੀ ਦੀਆਂ ਕਿਤਾਬਾਂ ਵਿੱਚ ਕਹਾਣੀਆਂ ਹੀ ਕਹਾਣੀਆਂ ਹੁੰਦੀਆਂ ਹਨ ਜੋ ਸਾਨੂੰ ਪ੍ਰੇਰਿਤ ਕਰਦੀਆਂ ਹਨ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਅਤੇ ਇਹਨਾਂ ਨਾਲ ਸਾਨੂੰ ਬਹੁਤ ਜ਼ਿਆਦਾ ਇੰਟਰਟੇਨਮੈਂਟ ਵੀ ਮਿਲਦਾ ਹੈ ਕਿਉਂਕਿ ਇਹ ਕਿਤਾਬਾਂ ਸਾਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਦੀ ਸਿੱਖਿਆ ਵੀ ਦਿੰਦੀਆਂ ਹਨ ਜਿੱਦਾਂ ਅਸੀਂ ਕਹਾਣੀ ਸੁਣੀ ਹੋਊਗੀ ਜਿਹੜੀ ਲਾਲਚੀ ਕੁੱਤੇ ਵਾਲੀ ਕਿ ਉਹ ਲਾਲਚ ਕਰਕੇ ਆਪਣੀ ਜੋ ਹੱਡੀ ਹੁੰਦੀ ਹੈ ਉਹਨੂੰ ਵੀ ਸੁੱਟ ਦਿੰਦਾ ਹੈ ਕਿਉਂਕਿ ਉਹਨੂੰ ਲਾਲਚ ਹੋ ਜਾਂਦਾ ਹੈ ਕਿ ਜੋ ਸਾਹਮਣੇ ਉਹਦੇ ਕੁੱਤਾ ਹੈ ਉਹਦੀ ਹੱਡੀ ਵੀ ਉਹਨੂੰ ਮਿਲ ਜਾਵੇ ਅਤੇ ਅਸੀਂ ਇੱਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਵੀ ਪੜ੍ਹੀਆਂ ਹਨ ਜਿੱਦਾਂ ਕਿ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਆਦਿ